ਹੈਲੋ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਦੇਖੋ ਹੁਣ ਤਾਂ ਹਨੇਰਾ ਹੋ ਗਿਆ ਵਾ ਸਵੇਰੇ ਮੈਂ ਬੈਠਣਾ ਵਾ ਤਰਨਤਾਰਨ ਮਿੱਤਲ ਹੌਸਪਿਟਲ ਤੁਸੀਂ ਉੱਥੇ ਆ ਜਿਓ ਅਤੇ ਫਿਲਹਾਲ ਤੁਸੀਂ ਪੈਰਾ ਪੈਰਾਸੀਟਾਮੌਲ ਲੈ ਲਓ ਤਾਂ ਉਹਦੇ ਨਾਲ ਤੁਹਾਡੇ ਪੀੜ ਦਾ ਤੁਹਾਨੂੰ ਫ਼ਰਕ ਪਊਗਾ ਬਾਕੀ ਇਹ ਕਿ ਸਵੇਰੇ ਮੈਂ ਉੱਥੇ ਦੇਖੂੰਗਾ ਦੇਖ ਕੇ ਤੁਹਾਨੂੰ ਦੱਸੂੰਗਾ ਬਾਕੀ ਦੇਖੂੰਗੀ ਦੇਖ ਕੇ ਤੁਹਾਨੂੰ ਦੱਸੂੰਗੀ ਬਾਕੀ ਇਹ ਆ ਕਿ ਤੁਸੀਂ ਜੇ ਐੱਮ ਆਰ ਆਈ ਕਰਵਾਉਣੀ ਪਊਗੀ ਜਾਂ ਆਪਾਂ ਨੂੰ ਐਕਸਰਾ ਕਰਵਾਉਣਾ ਪਊਗਾ ਤਾਂ ਫਿਰ ਆਪਾਂ ਕਰਾ ਲਾਂਗੇ ਉੱਥੇ ਹਾਂਜੀ ਚਲੋ ਕੋਈ ਗੱਲ ਨਹੀਂ ਤੁਸੀਂ ਆਪਣੇ ਇੱਥੇ ਤੁਹਾਡੇ ਨੇੜੇ ਸ਼ਹਿਰ ਦੇ ਜੇ ਕੋਈ ਹੈਗਾ ਤਾਂ ਕੋਈ ਗੱਲ ਨਹੀਂ ਤੁਸੀਂ ਦਿਖਾ ਲਓ ਬਾਕੀ ਮੇਰਾ ਤਾਂ ਸਵੇਰੇ ਕੱਲ੍ਹ ਕੱਲ੍ਹ ਚਾਰ ਵਜੇ ਦਾ ਹੀ ਸਮਾਂ ਮੈਂ ਤਾਂ ਤੁਹਾਨੂੰ ਉੱਥੇ ਮਿਲੂੰਗੀ ਹਾਂਜੀ ਇਹਦੇ ਵਾਸਤੇ ਤਾਂ ਤੁਹਾਨੂੰ ਕੋਈ ਪੇਨ ਕਿੱਲਰ ਹੀ ਲੈਣੀ ਪੈਣੀ ਫਿਰ ਤੁਸੀਂ ਉਹ ਲੈ ਸਕਦੇ ਜੇ ਆਪਣੇ ਲਾਗੋਂ ਕਿਤੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ